ਹਾਂਜੀ ਇੱਕ ਵਾਰ ਮੈਂ ਇੱਕ ਆਪਣਾ ਸੂਟ ਦਾ ਡਿਜ਼ਾਇਨ ਤਿਆਰ ਕਰ ਰਹੀ ਸੀ ਜੋ ਕਿ ਮੈਂ ਨੈੱਟ ਤੋਂ ਔਨਲਾਈਨ ਦੇਖਿਆ ਸੀ ਉਹ ਮੈਨੂੰ ਦੇਖਣ ਨੂੰ ਇੰਨਾਂ ਕੁ ਵਧੀਆ ਲੱਗਾ ਪਰ ਮਨ ਵਿੱਚ ਕਿਤੇ ਨਾ ਕਿਤੇ ਇਹ ਵੀ ਡਰ ਸੀ ਵੀ ਕਿਤੇ ਗਲਤ ਨਾ ਹੋ ਜੇ ਪਰ ਫਿਰ ਵੀ ਮੈਂ ਮਿਹਨਤ ਕੀਤੀ ਹੋ ਗਿਆ ਡਰ ਦੀ ਵਜ੍ਹਾ ਨਾਲ ਜਦੋਂ ਸੂਟ ਕੱਟਿਆ ਤਾਂ ਉਹਦਾ ਗਲਾ ਥੋੜ੍ਹਾ ਜਿਹਾ ਬਰੋਡ ਔਰ ਡੀਪ ਹੋ ਗਿਆ ਪਰ ਫਿਰ ਮੈਂ ਆਰਾਮ ਨਾਲ ਸੂਟ ਨੂੰ ਇੱਕ ਸਾਈਡ 'ਤੇ ਰੱਖ ਕੇ ਆਰਾਮ ਨਾਲ ਬੈਠ ਗਈ ਬੈਠ ਕੇ ਕੁਛ ਟਾਈਮ ਸੋਚਿਆ ਵੀ ਇਹਦਾ ਹੁਣ ਕੀ ਹੱਲ ਹੋ ਸਕਦਾ ਆ ਉਦੋਂ ਫਿਰ ਮੈਂ ਆਰਾਮ ਦੇ ਨਾਲ ਇਹ ਸੋਚਿਆ ਫਿਰ ਮੈਂ ਇੱਕ ਬਜ਼ਾਰ ਗਈ ਬਜ਼ਾਰ ਦੇ ਵਿੱਚੋਂ ਨੈੱਟ ਲਿਆਉਂਦੀ ਔਰ ਇੱਕ ਪਾਈਪਿੰਗ ਲਿਆਉਂਦੀ ਪਾਈਪਿੰਗ ਨੂੰ ਨਾਲ ਨਾਲ ਜੋੜ ਕੇ ਨਾਲ ਨਾਲ ਹੀ ਨੈੱਟ ਅਟੈਚ ਕੀਤੀ ਨੈੱਟ ਅਟੈਚ ਕਰਨ ਤੋਂ ਬਾਅਦ ਮੈਂ ਉਸ ਨੂੰ ਇੱਕ ਨਵੇਂ ਡਿਜ਼ਾਇਨ ਦੇ ਵਿੱਚ ਕਰਤਾ ਜੋ ਮੇਰਾ ਨੈਕ ਦਾ ਡਿਜ਼ਾਇਨ ਡੀਪ ਸੀ ਅਤੇ ਬਰੋਡ ਸੀ ਉਹ ਤਾਂ ਸੈੱਟ ਹੋਇਆ ਹੋਇਆ ਉਸ ਦੇ ਨਾਲ ਨਾਲ ਇੱਕ ਨਵਾਂ ਮਤਲਬ ਕਿ ਡਿਜ਼ਾਇਨ ਕ੍ਰੀਏਟ ਹੋ ਗਿਆ ਮਤਲਬ ਮੇਰੇ ਮਨ 'ਚ ਇਹ ਡਰ ਸੀ ਵੀ ਸੂਟ ਸੈੱਟ ਨਹੀਂ ਆਉਣਾ ਜਦ ਮੈਂ ਦੁਬਾਰਾ ਫਿਰ ਉਹਨੂੰ ਸੂਟ ਨੂੰ ਵੇਅਰ ਕਰਕੇ ਦੇਖਿਆ ਉਹ ਡਿਜ਼ਾਇਨ ਇੰਨਾਂ ਕੁ ਸੋਹਣਾ ਹੋ ਗਿਆ ਮਤਲਬ ਮੈਨੂੰ ਕਿਤੇ ਨਾ ਕਿਤੇ ਬਹੁਤ ਖੁਸ਼ੀ ਹੋਈ ਵੀ ਮੇਰਾ ਸੂਟ ਦਾ ਡਿਜ਼ਾਇਨ ਠੀਕ ਹੋ ਗਿਆ ਐਵੇਂ ਹੀ ਸੇਮ ਪਿਛਲੇ ਸਾਲ ਦੀ ਗੱਲ ਆ ਸਰਦੀਆਂ ਦੀ ਜਦ ਮੈਂ ਆਪਣੀ ਸਲਵਾਰ ਪ੍ਰੈੱਸ ਕਰ ਰਹੀ ਸੀ ਉਹਦੇ ਥੋੜ੍ਹੀ ਜਿਹੀ ਮੂਰੀ ਤੋਂ ਮੇਰੀ ਸਲਵਾਰ ਸੜ ਗਈ ਪ੍ਰੈੱਸ ਲੱਗ ਗਈ ਪ੍ਰੈੱਸ ਲੱਗਣ ਤੋਂ ਬਾਅਦ ਜਦੋਂ ਮੈਂ ਉਹਨੂੰ ਫਿਰ ਆਰਾਮ ਦੇ ਮੇਰਾ ਮਨ ਬਹੁਤ ਖਰਾਬ ਹੋਇਆ ਸਾਰੀ ਰਾਤ ਮੈਂ ਸੋਚੀ ਗਈ ਵੀ ਹੁਣ ਮੈਨੂੰ ਨਵਾਂ ਕੱਪੜਾ ਲਿਆਉਣਾ ਜਦ ਮੈਂ ਮਾਰਕੀਟ ਵਿੱਚ ਗਈ ਮੈਨੂੰ ਸੇਮ ਕਲਰ ਦਾ ਨਵਾਂ ਕੱਪੜਾ ਨਹੀਂ ਮਿਲਿਆ ਕਲਰ ਵਿੱਚ ਡਿਫਰੈਂਸ ਆ ਰਿਹਾ ਸੀ ਫਿਰ ਮੈਂ ਆਰਾਮ ਨਾਲ ਘਰ ਆ ਕੇ ਸੋਚਿਆ ਵੀ ਇਹਦਾ ਕੀ ਹੱਲ ਹੋ ਸਕਦਾ ਕਿਉਂਕਿ ਸੂਟ ਮੈਂ ਇੱਕ ਦੋ ਵਾਰ ਹੀ ਪਾਇਆ ਸੀ ਤਾਂ ਉਸ ਤੋਂ ਬਾਅਦ ਮੈਂ ਸੂਟ ਆਰਾਮ ਨਾਲ ਸੋਚਿਆ ਫਿਰ ਮੈਂ ਸੋਚਿਆ ਵੀ ਇਸ ਦੀ ਮੋਰੀ ਉਧੇੜੀ ਜਾਵੇ ਮੋਰੀ ਉਧੇੜਨ ਤੋਂ ਬਾਅਦ ਉਹ ਵਾਲਾ ਕੱਪੜਾ ਉੱਪਰ ਪੀਸ ਜਾਊਗਾ ਉੱਪਰ ਵਾਲਾ ਪੀਸ ਨੀਚੇ ਆ ਜੂਗਾ ਉੱਪਰ ਥੋੜ੍ਹਾ ਜਿਹਾ ਪੀਸ ਨੂੰ ਟਾਕੀ ਲਗਾ ਕੇ ਪਾ ਦਿੱਤਾ ਜਾਵੇਗਾ ਔਰ ਮਤਲਬ ਮੇਰੀ ਮੇਰਾ ਸੂਟ ਨਵਾਂ ਪੂਰਾ ਤਿਆਰ ਹੋ ਗਿਆ ਇਸ ਤੋਂ ਮਤਲਬ ਮੈਨੂੰ ਇੱਕ ਖੁਸ਼ੀ ਤਾਂ ਹੋਈ ਵੀ ਮੇਰੇ ਪੈਸੇ ਦੀ ਬੱਚਤ ਹੋ ਗਈ ਜੇ ਨਵਾਂ ਕੱਪੜਾ ਮਿਲਦਾ ਉਹਦੇ ਲਈ ਪੰਜ ਛੇ ਸੌ ਰੁਪਏ ਦਾ ਪੀਸ ਆਉਣਾ ਸੀ ਫਿਰ ਮੈਂ ਸਟਿੱਚ ਕਰਾਉਂਦੀ ਇਹਦੇ ਨਾਲ ਬੇਹਤਰ ਵੀ ਜਦ ਮੈਂ ਖੁਦ ਸਿਲਾਈ ਕੀਤੀ ਅਤੇ ਮੈਨੂੰ ਮੇਰੇ ਪੈਸੇ ਦੀ ਬੱਚਤ ਵੀ ਹੋਈ ਅਤੇ ਮੈਨੂੰ ਖੁਸ਼ੀ ਵੀ ਹੋਈ ਵੀ ਮੇਰਾ ਸੂਟ ਠੀਕ ਹੋ ਗਿਆ ਇਸ ਤੋਂ ਅਨੁਭਵ ਇਹੀ ਕੀਤਾ ਵੀ ਜਦ ਆਪਣੇ ਹੱਥ ਵਿੱਚ ਹੁਨਰ ਹੋਵੇ ਆਪਾਂ ਆਰਾਮ ਦੇ ਨਾਲ ਬੈਠ ਕੇ ਠੰਡੇ ਦਿਮਾਗ ਨਾਲ ਕੁਛ ਨਾ ਕੁਛ ਸੋਚਾਂਗੇ ਤਾਂ ਕਦੇ ਵੀ ਘਾਟਾ ਨਹੀਂ ਪੈਂਦਾ ਤਾ ਔਰ ਉਸ ਚੀਜ਼ ਵਿੱਚ ਫਾਇਦਾ ਹੀ ਫਾਇਦਾ ਹੁੰਦਾ ਹੈ